ਪੁਰਾਣੇ ਗੀਤਾਂ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਿੱਠੇ ਅਤੇ ਵਧੀਆ ਬੋਲ ਦਿ ਦਿੱਤੇ ਜਾਂਦੇ ਸੀ ਅਤੇ ਵਧੀਆ ਹੀ ਬਹੁਤ ਹੀ ਜ਼ਿਆਦਾ ਆਰਾਮਦਾਇਕ ਗੀਤ ਸੀਗਾ ਜਿਸ ਵਿੱਚ ਅਸੀਂ ਹੌਲੀ ਹੌਲੀ ਗੀਤ ਚੱਲਦਾ ਸੀ ਅਸੀਂ ਆਰਾਮ ਨਾਲ ਸੁਣਦੇ ਸੀ ਜਿਸ ਤੋਂ ਸਾਨੂੰ ਪੂਰੀ ਸਮਝ ਵੀ ਆਉਂਦੀ ਸੀਗੀ ਪਰ ਅੱਜ ਦੇ ਇਸ ਗੀਤਾਂ ਵਿੱਚ ਸਾਨੂੰ ਗੀਤ ਦੇ ਬੋਲ ਘੱਟ ਸੁਣਾਈ ਦਿੰਦੇ ਹਨ ਅਤੇ ਬੈਕਗਰਾਊਂਡ ਮਊਜਿਕ ਮਿਊਜਿਕ ਜ਼ਿਆਦਾ ਸੁਣਾਈ ਦਿੰਦਾ ਹੈ ਅੱਜ ਦੇ ਗੀਤਾਂ ਵਿੱਚ ਕੁਝ ਇਹੋ ਜਿਹੇ ਸ਼ਬਦ ਹਨ ਜੋ ਬਹੁਤ ਹੀ ਜ਼ਿਆਦਾ ਔਖੇ ਹਨ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਹੈ ਜੋ ਕਿ ਉਸਦਾ ਮਤਲਬ ਕੀ ਹੈ ਅਤੇ ਬਹੁਤ ਹੀ ਜ਼ਿਆਦਾ ਇਹੋ ਜਿਹੇ ਸ਼ਬਦ ਬੋਲੇ ਜਾਂਦੇ ਹਨ ਜਾਂ ਵਿੱਚ ਬੋਲ ਲਿਤੇ ਜਾਂਦੇ ਹਨ ਜਿਨ੍ਹਾਂ ਦੇ ਸਾਨੂੰ ਅੱਜ ਤਾਈਂ ਮਤਲਬ ਨਹੀਂ ਪਤਾ ਪੁਰਾਣੇ ਗੀਤਾਂ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਅਤੇ ਪਿਆਰ ਭਰੇ ਸ਼ਬਦ ਦਿੱਤੇ ਜਾਂਦੇ ਹਨ ਸ ਅਤੇ ਬਹੁਤ ਹੀ ਜ਼ਿਆਦਾ ਇੰਨਾ ਸ ਸਰਲ ਗੀਤ ਹੁੰਦਾ ਸੀ ਵੀ ਅਸੀਂ ਉਸਨੂੰ ਗੀਤ ਨੂੰ ਵਧੀਆ ਗਾ ਸਕਦੇ ਸੀਗੇ ਪਰ ਆਹ ਹੁਣ ਦੇ ਗੀਤਾਂ ਬਹੁਤ ਹੀ ਜ਼ਿਆਦਾ ਔਖੇ ਗੀਤ ਹੋ ਗਏ ਹਨ ਪਹਿਲਾਂ ਪਹਿਲਾਂ ਹਿੰਦੀ ਗੀਤ ਸੀ ਜੋ ਪੁਰਾਣੇ ਜ਼ਮਾਨੇ ਦੇ ਵਧੀਆ ਚੱਲਦੇ ਸੀ ਪਰ ਅੱਜ ਦੇ ਹਿੰਦੀ ਗੀਤਾਂ ਵਿੱਚ ਹੱਦ ਤੋਂ ਵੱਧ ਜ਼ਿਆਦਾ ਅੰਗਰੇਜ਼ੀ ਦੇ ਸ਼ਬਦ ਦਿੱਤੇ ਜਾਂਦੇ ਹਨ ਵਿੱਚ ਅੰਗਰੇਜ਼ੀ ਸ਼ਬਦ ਹੱਦ ਤੋਂ ਵੱਧ ਅੰਗਰੇਜ਼ੀ ਬੋਲੀ ਜਾਂਦੀ ਹੈ ਅਤੇ ਹਿੰਦੀ ਗੀਤਾਂ ਵਿੱਚ ਹਿੰਦੀ ਬਹੁਤ ਹੀ ਜ਼ਿਆਦਾ ਘੱਟ ਵਰਤੀ ਜਾਂਦੀ ਆ ਅਤੇ ਜੇਕਰ ਹਿੰਦੀ ਵਰਤੀ ਜਾਂਦੀ ਆ ਉਹ ਸ਼ਬਦ ਬਹੁਤ ਹੀ ਜ਼ਿਆਦਾ ਬਹੁਤ ਹੀ ਉਹ ਸ਼ਬਦ ਨੂੰ ਬਹੁਤ ਹੀ ਜ਼ਿਆਦਾ ਅਤੇ ਉਹ ਓ ਸ਼ਬਦ ਕਈ ਉਹੋ ਜਿਹੇ ਸ਼ਬਦ ਹਨ ਜੋ ਆਪਾਂ ਨਹੀਂ ਵਰਤ ਸਕਦੇ ਅਤੇ ਉਹਨਾਂ ਨੂੰ ਵਰਤ ਉਹ ਵਰਤ ਉਹ ਵਰਤੇ ਜਾਂਦੇ ਹਨ ਅਤੇ ਸਾਨੂੰ ਉਹਨਾਂ ਦਾ ਮਤਲਬ ਵੀ ਨਹੀਂ ਪਤਾ ਹੁੰਦਾ